ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੇ ਰੈਸਟੋਰੈਂਟ ਤੋਂ ਜਿਹੜਾ ਸੀ ਉਹ ਭੋਜਨ ਔਡਰ ਕੀਤਾ ਸੀ ਅਤੇ ਜਿਹੜਾ ਬਹੁਤ ਹੀ ਘਟੀਆ ਕੁਆਲਿਟੀ ਦਾ ਜਿਹੜਾ ਨਿਕਲਿਆ ਜਿਹਦੇ ਕਾਰਨ ਮੈਨੂੰ ਸਮਾਜ ਵਿੱਚ ਜਿਹੜੀ ਆ ਉਹ ਬਹੁਤ ਸ਼ਰਮਿੰਦਗੀ ਦਾ ਵੀ ਜਿਹੜਾ ਸਾਹਮਣਾ ਕਰਨਾ ਪਿਆ ਕਿਉਂਕਿ ਮੈਂ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਪਾਰਟੀ ਰੱਖੀ ਸੀ ਮੇਰੇ ਬੱਚੇ ਦਾ ਜਨਮਦਿਨ ਸੀ ਉਹਦੇ ਨਾਲ ਸੰਬੰਧਿਤ ਅਤੇ ਮੇਰੀ ਸਹੇਲੀ ਦੇ ਕਹਿਣ 'ਤੇ ਮੈਂ ਤੁਹਾਡੇ ਰੈਸਟੋਰੈਂਟ ਤੋਂ ਜਿਹੜਾ ਸੀ ਉਹ ਭੋਜਨ ਔਡਰ ਕੀਤਾ ਉਹਨੇ ਤੁਹਾਡੇ ਰੈਸਟੋਰੈਂਟ ਦੀ ਕਾਫੀ ਤਾਰੀਫ ਕੀਤੀ ਸੀ ਕਾਫੀ ਵਾਰ ਉਹਨਾਂ ਨੇ ਉੱਥੋਂ ਬਹੁਤ ਕੁਛ ਮੰਗਵਾਇਆ ਸੀ ਅਤੇ ਉਹ ਵਧੀਆ ਵੀ ਰਿਹਾ ਸੀ ਉਹਦੇ ਕਹਿਣ 'ਤੇ ਜਿਹੜਾ ਇਹ ਮੈਂ ਔਡਰ ਕੀਤਾ ਪਰ ਇਹਦੇ ਵਿੱਚੋਂ ਜੋ ਵੀ ਭੋਜਨ ਮਿਲਿਆ ਉਹ ਬਹੁਤ ਹੀ ਘਟੀਆ ਕੁਆਲਿਟੀ ਦਾ ਸੀ ਉਹਦੇ ਵਿੱਚੋਂ ਬਹੁਤ ਜਿਹੜੀ ਦੁਰਗੰਧ ਜਿਹੜੀ ਸੀ ਆ ਰਹੀ ਸੀ ਜਿਹਦਾ ਕਾਰਨ ਜਦੋਂ ਮੈਂ ਉਹਨੂੰ ਪੈਕਿੰਗ ਨੂੰ ਖੋਲ੍ਹਿਆ ਅਤੇ ਜਿੰਨੇ ਵੀ ਰਿਸ਼ਤੇਦਾਰ ਬੈਠੇ ਸੀ ਉਹਨਾਂ ਸਾਹਮਣੇ ਮੈਨੂੰ ਬੜੀ ਸ਼ਰਮਿੰਦਗੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਅਤੇ ਮੈਨੂੰ ਉਸ ਸਮੇਂ 'ਤੇ ਕਿਸੇ ਹੋਰ ਰੈਸਟੋਰੈਂਟ ਤੋਂ ਜਿਹੜਾ ਵਾ ਉਹ ਭੋਜਨ ਬਣਾਉਣਾ ਮੰਗਵਾਉਣਾ ਪਿਆ ਕਿਉਂਕਿ ਹੁਣ ਉਸ ਹਾਲਤ ਵਿੱਚ ਘਰ 'ਚ ਬਣਾਉਣਾ ਤਾਂ ਜਿਹੜਾ ਸੀ ਉਹ ਮੁਸ਼ਕਲ ਸੀ ਰਿਸ਼ਤੇਦਾਰ ਵੀ ਸੀਗੇ ਅਤੇ ਫਿਰ ਮੈਂ ਉੱਥੋਂ ਮੰਗਵਾ ਕੇ ਜਿਹੜਾ ਵਾ ਉਹ ਉਹਨਾਂ ਨੂੰ ਭੋਜਨ ਕਰਵਾਇਆ ਅਤੇ ਆਪਣਾ ਜਿਹੜਾ ਟਾਈਮ ਸਾਰਿਆ ਪਰ ਤੁਹਾਡੇ ਇਸ ਭੇਜੇ ਹੋਏ ਔਡਰ ਦੇ ਨਾਲ ਮੈਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਮੈਂ ਤਾਂ ਇਹੀ ਚਾਹਾਂਗੀ ਕਿ ਤੁਸੀਂ ਜੋ ਵੀ ਮੈਂ ਤੁਹਾਨੂੰ ਪੈਸੇ ਦਿੱਤੇ ਆ ਉਹ ਕਿਰਪਾ ਕਰਕੇ ਜਿਹੜਾ ਵਾ ਉਹ ਰਿਫੰਡ ਕੀਤੇ ਜਾਣ ਕਿਉਂਕਿ ਇਹਦੇ ਨਾਲ ਮੈਨੂੰ ਦੋਹਰਾ ਭੁਗਤਾਨ ਕਰਨਾ ਪਿਆ ਇੱਕ ਮੈਂ ਤੁਹਾਡੇ ਰੈਸਟੋਰੈਂਟ ਨੂੰ ਪੇਮੈਂਟ ਕੀਤੀ ਇੱਕ ਮੈਂ ਦੂਜੇ ਨੂੰ ਕੀਤੀ ਜਿਹਦਾ ਕਰਕੇ ਮੈਨੂੰ ਜਿਹੜਾ ਵਾ ਨੁਕਸਾਨ ਹੋਇਆ ਅਤੇ ਤੁਹਾਡਾ ਭੋਜਨ ਜਿਹੜਾ ਵਾ ਉਹ ਮੈਂ ਉਸੇ ਤਰ੍ਹਾਂ ਹੀ ਪੈਕ ਰੱਖਿਆ ਵਾ ਬੇਸ਼ੱਕ ਤੁਸੀਂ ਉਹਨੂੰ ਵਾਪਸ ਲੈ ਜਾਉ ਅਤੇ ਮੇਰੇ ਜਿਹੜੇ ਪੈਸੇ ਆ ਉਹ ਤੁਸੀਂ ਵਾਪਸ ਕਰ ਦਿਉ ਧੰਨਵਾਦ